ਨਹੀਂ ਮੈਨੂੰ ਨਹੀਂ ਲੱਗਦਾ ਕਿ ਨਿਊਜ਼ ਮੀਡੀਆ ਜਿਹੜਾ ਪੇਂਡੂ ਖੇਤਰਾਂ ਬਾਰੇ ਕਾਫੀ ਮੁੱਦੇ ਦਿਖਾਉਂਦਾ ਹੈ ਉਹ ਸਿਰਫ ਓਸ ਉਹਨਾਂ ਮੁੱਦਿਆਂ ਨੂੰ ਚੱਕਦਾ ਹੈ ਕਿ ਪਿੰਡਾਂ ਵਿੱਚ ਵਿਕਾਸ ਕਿੰਨਾ ਵਧ ਰਿਹਾ ਹੈ ਜਦੋਂ ਕਿ ਵਿਕਾਸ ਦਾ ਲੈਵਲ ਪਿੰਡਾਂ ਵਿੱਚ ਬਹੁਤ ਘੱਟ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਜਿਹੇ ਮੁੱਦੇ ਹਨ ਜਿਹਨਾਂ ਬਾਰੇ ਮੀਡੀਆ ਵਿੱਚ ਗੱਲ ਹੀ ਨਹੀਂ ਕੀਤੀ ਜਾਂਦੀ ਜਿਵੇਂ ਕਿ ਪਿੰਡਾਂ ਦੇ ਵਿੱਚ ਚਾਇਲਡ ਲੇਬਰ ਹੁੰਦੀ ਹੈ ਚੌਦਾਂ ਸਾਲ ਤੋਂ ਘੱਟ ਬੱਚੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਕੰਮਾਂ ਉੱਤੇ ਲੱਗੇ ਹੋਏ ਹਨ ਕੀ ਮੀਡੀਆ ਦੇ ਵਿੱਚ ਉਹ ਚੀਜ਼ ਦਿਖਾਈ ਜਾਂਦੀ ਹੈ ਨਹੀਂ ਉਸ ਚੀਜ਼ ਨੂੰ ਇਗਨੋਰ ਕੀਤਾ ਜਾਂਦਾ ਜਦੋਂ ਮੀਡੀਆ ਦੇ ਵਿੱਚ ਜਦੋਂ ਪਿੰਡਾਂ ਦੇ ਵਿੱਚ ਪੰਚਾਇਤ ਦੇ ਇਲੈਕਸ਼ਨਜ਼ ਹੁੰਦੇ ਹਨ ਉਹਨਾਂ ਵਿੱਚ ਕਿੰਨਾ ਜ਼ਿਆਦਾ ਕਰਪਸ਼ਨ ਕੀ ਤੁਸੀਂ ਕਹਿ ਸਕਦੇ ਹੋ ਨੈਪੋਟੀਜ਼ਮ ਦਿਖਾਇਆ ਜਾਂਦਾ ਹੈ ਪਰ ਕੀ ਮੀਡੀਆ ਵਿੱਚ ਉਸ ਚੀਜ਼ ਨੂੰ ਕਵਰ ਕੀਤਾ ਜਾਂਦਾ ਹੈ ਨਹੀਂ ਕੀਤਾ ਜਾਂਦਾ ਮੀਡੀਆ ਸਿਰਫ ਗਵਰਨਮੈਂਟ ਦੇ ਪੱਖ ਦੀ ਗੱਲ ਕਰਦੀ ਹੈ ਜਿਹੜੀ ਕਿ ਜਿਹੜਾ ਕਿ ਬਹੁਤ ਗਲਤ ਹੈ ਮੀਡੀਆ ਨੂੰ ਸੱਚਾਈ ਦੇ ਸੱਚਾਈ ਨੂੰ ਪੇਸ਼ ਕਰਨਾ ਚਾਹੀਦਾ ਹੈ ਆਪਣੀਆਂ ਖਬਰਾਂ ਵਿੱਚ